ਅਸੀਂ ਬ੍ਰਹਿਮੰਡਾਂ ਅਤੇ ਉਸ ਦੇ ਰਹੱਸਾਂ ਬਾਰੇ ਸਭ ਤੋਂ ਵਧੀਆ ਦਿਲਚਸਪ ਗੱਲ ਇਹ ਲੱਗੀ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਬ੍ਰਹਿਮੰਡ ਦੇ ਰਹੱਸ ਬੜੇ ਗੂੜੇ ਹਨ ਇਹ ਸਾਰੇ ਖੰਡ ਬ੍ਰਹਿਮੰਡ ਪਰਮਾਤਮਾ ਨੇ ਪੈਦਾ ਕੀਤੇ ਹਨ ਕੋਟਿ ਬ੍ਰਹਿਮੰਡਾਂ ਦਾ ਸੁਆਮੀ ਪਰਮਾਤਮਾ ਅਕਾਲ ਪੁਰਖ ਹੈ ਬ੍ਰਹਿਮੰਡ ਬਿਨਾ ਆਧਾਰ ਤੋਂ ਹੀ ਟਿਕਿਆ ਹੋਇਆ ਹੈ ਇਹ ਸੰਸਾਰ ਨੂੰ ਜੀਵਨ ਦਿੰਦਾ ਹੈ ਇਸ ਤੋਂ ਸਾਨੂੰ ਊਰਜਾ ਮਿਲਦੀ ਹੈ ਬ੍ਰਹਿਮੰਡ ਵਿੱਚ ਕਰੋੜਾਂ ਸੂਰਜ ਹਨ ਜੋ ਸਾਡੇ ਜੀਵਨ ਦਾ ਕਾਰਨ ਹੈ ਇਸ ਸਾਨੂੰ ਬਹੁਤ ਹੀ ਦਿਲਚਸਪ ਅਤੇ ਜੀਵਨ ਦੀ ਰੁਚੀ ਪ੍ਰਦਾਨ ਕਰਦੇ ਹਨ